ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਕਰਤਾਰ ਟਰੈਵਲ ਏਜੰਸੀ ਤੋਂ ਗੱਲ ਕਰ ਰਹੇ ਜੀ ਭਾਅ ਜੀ ਮੈਂ ਅੱਜ ਨਵਾਂਸ਼ਹਿਰ ਤੋਂ ਮੋਹਾਲੀ ਏਅਰਪੋਰਟ ਜਾਣ ਲਈ ਤੁਹਾਡੀ ਕੈਬ ਬੁੱਕ ਕੀਤੀ ਸੀ ਜੀ ਅਤੇ ਪਹਿਲਾਂ ਹੀ ਮੇਰੀ ਤੁਹਾਡੇ ਨਾਲ ਗੱਲ ਹੋਈ ਸੀਗੀ ਇਹਦੇ ਕਿਰਾਏ ਬਾਰੇ ਅਤੇ ਅਸੀਂ ਤਿੰਨ ਚਾਰ ਲੋਕਾਂ ਨੇ ਜਾਣਾ ਸੀਗਾ ਏਅਰਪੋਰਟ 'ਤੇ ਬ੍ਰਦਰ ਨੂੰ ਰਿਸੀਵ ਕਰਨ ਅਤੇ ਤੁਹਾਡੀ ਏਜੰਸੀ ਨਾਲ ਮੇਰੀ ਗੱਲ ਹੋਈ ਸੀ ਅਤੇ ਆਪਣਾ ਫਾਈਨਲ ਹੋਇਆ ਸੀਗਾ ਕਿ ਦੋ ਹਜ਼ਾਰ ਰੁਪਏ ਵਿੱਚ ਕੈਬ ਬੁੱਕ ਕੀਤੀ ਸੀ ਪਰ ਹੁਣ ਜਿਹੜੇ ਤੁਹਾਡੇ ਇੱਥੇ ਡਰਾਈਵਰ ਹੈਗੇ ਨੇ ਉਹ ਮੇਰੇ ਤੋਂ ਵੱਧ ਪੈਸੇ ਮੰਗ ਰਹੇ ਨੇ ਉਹ ਮੈਨੂੰ ਤਿੰਨ ਹਜ਼ਾਰ ਰੁਪਇਆ ਪੇ ਕਰਨ ਲਈ ਕਹਿ ਰਹੇ ਨੇ ਅਤੇ ਮੈਂ ਇਹ ਫਾਲਤੂ ਪੈਸਿਆਂ ਦਾ ਭੁਗਤਾਨ ਨਹੀਂ ਕਰ ਸਕਦੀ ਕਿਉਂਕਿ ਮੇਰੇ ਪਹਿਲਾਂ ਹੀ ਤੁਹਾਡੇ ਨਾਲ ਗੱਲ ਹੋ ਚੁੱਕੀ ਸੀ ਦੋ ਹਜ਼ਾਰ ਰੁਪਏ ਵਿੱਚ ਅਤੇ ਤੁਸੀਂ ਆਪਣੇ ਡਰਾਈਵਰ ਨੂੰ ਗੱਲ ਕਰਕੇ ਉਹਨਾਂ ਨੂੰ ਸਮਝਾਓ ਕਿ ਜਿੰਨੇ ਵਿੱਚ ਸਾਡੀ ਡੀਲ ਹੋਈ ਹੈ ਦੋ ਹਜ਼ਾਰ ਰੁਪਏ ਦੀ ਅਸੀਂ ਉਨੇ ਪੈਸਿਆਂ ਵਿੱਚ ਹੀ ਕੈਬ ਬੁੱਕ ਕੀਤੀ ਹੈ ਅਤੇ ਅਸੀਂ ਉਨਾਂ ਹੀ ਭੁਗਤਾਨ ਕਰਾਂਗੇ